ਮੇਰਾ ਨਾਮ ਰਣਜੀਤ ਸਿੰਘ ਹੈ ਅਤੇ ਮੇਰੇ ਪਿਤਾ ਜੀ ਦਾ ਨਾਮ ਡਾਕਟਰ ਹਰਬੰਸ ਸਿੰਘ ਹੈ ਮੇਰੀ ਉਮਰ ਤਰਤਾਲ਼ੀ ਸਾਲ ਹੈ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ 'ਚ ਪੜ੍ਹਾਉਂਦਾ ਹਾਂ ਉੱਥੇ ਮੈਂ ਮਕੈਨਿਕਲ ਇੰਜੀਨੀਅਰਿੰਗ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਹਾਂ ਅਤੇ ਮੈਂ ਇੱਥੇ ਸੰਨ ਦੋ ਹਜ਼ਾਰ ਬਾਰਾਂ ਤੋਂ ਪੜ੍ਹਾ ਰਿਹਾ ਤਕਰੀਬਨ ਮੈਨੂੰ ਗਿਆਰਾਂ ਸਾਲ ਹੋ ਗਏ ਇੱਥੇ ਪੜ੍ਹਾਉਂਦੇ ਨੂੰ ਇਸ ਤੋਂ ਪਹਿਲਾਂ ਮੈਂ ਸੰਤ ਲੌਂਗੋਵਾਲ ਇੰਸਟੀਟਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਵਿੱਚੋਂ ਪੀ ਐੱਚ ਡੀ ਕੀਤੀ ਹੈ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਅਤੇ ਉਸ ਤੋਂ ਪਹਿਲਾਂ ਮੈਂ ਐੱਮ ਟੈਕ ਆਪਣੀ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰ ਕੋਲਜ ਤੋਂ ਪੂਰੀ ਕੀਤੀ ਸੀ ਅਤੇ ਹੁਣ ਮੈਂ ਇੱਥੇ ਯੂਨੀਵਰਸਿਟੀ 'ਚ ਮਕੈਨੀਕਲ ਇੰਜੀਨੀਅਰਿੰਗ 'ਚ ਪੜ੍ਹਾ ਰਿਹਾ ਅਤੇ ਮੇਰੇ ਜਿਹੜੇ ਸਬਜੈਕਟ ਨੇ ਉਹ ਜਿਵੇਂ ਮਕੈਨਿਕਲ ਇੰਜੀਨੀਅਰਿੰਗ ਡਰਾਇੰਗ ਹੁੰਦੀ ਹੈ ਉਹ ਪੜ੍ਹਾਉਂਦਾ ਮੈਂ ਅਤੇ ਮੇਰੀ ਰੁਚੀ ਡਰਾਇੰਗ ਦੇ ਵਿੱਚ ਸ਼ੁਰੂ ਤੋਂ ਹੀ ਰਹੀ ਹੈ ਮੈਨੂੰ ਡਰਾਇੰਗ ਕਰਨਾ ਬਹੁਤ ਪਸੰਦ ਸੀ ਅਤੇ ਘਰ ਜਦੋਂ ਵੀ ਵਕਤ ਵਿਹਲਾ ਹੁੰਦਾ ਸੀ ਮੈਂ ਆਪਣੀ ਡਰਾਇੰਗ ਦੀ ਕਾਪੀ ਚੱਕ ਕੇ ਉਹ ਉਹਦੇ ਉੱਪਰ ਕੁਛ ਨਾ ਕੁਛ ਆਪਣੇ ਵੱਲੋਂ ਬਣਾਉਂਦਾ ਹੁੰਦਾ ਸੀਗਾ ਅਤੇ ਜਦੋਂ ਮੈਂ ਇੰਜੀਨੀਅਰਿੰਗ ਦੇ ਵਿੱਚ ਪਤਾ ਲੱਗਿਆ ਕਿ ਇੰਜੀਨੀਅਰਿੰਗ ਡਰਾਇੰਗ ਸਬਜੈਕਟ ਹੁੰਦਾ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਅਤੇ ਹੁਣ ਉਸ ਤੋਂ ਬਾਅਦ ਜਦੋਂ ਦਾ ਮੈਂ ਪੜ੍ਹਾ ਰਿਹਾ ਮੈਂ ਇੰਜੀਨੀਅਰਿੰਗ ਡਰਾਇੰਗ ਹਰ ਸਾਲ ਜਾਣੀ ਦੋ ਸਮੈਸਟਰ ਹੁੰਦੇ ਨੇ ਦੋ ਸਮੈਸਟਰਾਂ 'ਚ ਹਰ ਵਾਰ ਡਰਾਇੰਗ ਪੜ੍ਹਾਈ ਹੈ ਅਤੇ ਮੇਰਾ ਮੇਨ ਸਬਜੈਕਟ ਹੀ ਡਰਾਇੰਗ ਬਣ ਗਿਆ ਅਤੇ ਇਹ ਮੇਰੀ ਰੁਚੀ ਵੀ ਸੀ ਜਿਸ ਕਰਕੇ ਮੈਨੂੰ ਇਹ ਪੜ੍ਹਾਉਣਾ ਬਹੁਤ ਚੰਗਾ ਲੱਗਦਾ ਬਾਕੀ ਮੈਂ ਥੋੜ੍ਹਾ ਜਿਹਾ ਸੰਗੀਤ 'ਚ ਵੀ ਇੰਟਰਸਟ ਰੱਖਦਾ ਮੈਂ ਉਹ ਵੀ ਕਦੇ ਕਦੇ ਆਪਣਾ ਜਿਵੇਂ ਸ਼ਬਦ ਗਾਇਨ ਵਗੈਰਾ ਕਰਦਾ ਰਹਿੰਦਾ ਹਾਂ ਮੇਰੇ ਕੋਲ ਹਾਰਮੋਨੀਅਮ ਹੈ ਤਬਲਾ 'ਤੇ ਪ੍ਰੈਕਟਿਸ ਹੁੰਦੀ ਰਹਿੰਦੀ ਆ ਅਤੇ ਬਾਕੀ ਵਧੀਆ ਹੈ ਜੋਬ ਮੈਨੂੰ ਬਹੁਤ ਵਧੀਆ ਲੱਗਦੀ ਹੈ ਆਪਣੀ ਟੀਚਿੰਗ ਦੀ